ਮੇਰੇ ਅਨੁਸਾਰ ਜਿਹੜਾ ਮੇਰੀ ਸਮਝ ਦੇ ਵਿੱਚ ਸਭ ਤੋਂ ਵਧੀਆ ਤਕਨੀਕੀ ਗੈਜੇਟ ਹੈ ਉਹ ਫਲੀਪਰ ਜ਼ੀਰੋ ਹੈ ਇਹ ਇੱਕ ਹੈਕਿੰਗ ਡਿਵਾਇਜ਼ ਹੈ ਇਹ ਵਾਈਫਾਈ ਵੀ ਹੈਕ ਕਰ ਸਕਦਾ ਇਹ ਚਾਬੀਆਂ ਦੀ ਕੋਪੀ ਵੀ ਬਣਾ ਸਕਦਾ ਇਹਦੇ ਨਾਲ ਕਾਰ ਦੇ ਲੋਕ ਵੀ ਹੈਕ ਕੀਤੇ ਜਾ ਸਕਦੇ ਨੇ ਮਤਲਬ ਬਹੁਤ ਕੰਮ ਕਰ ਸਕਦਾ ਇਹ ਅਤੇ ਇਹ ਜਿਹੜੇ ਆਪਣੇ ਏ ਟੀ ਐੱਮ ਕਾਰਡ ਡੈਬਿਟ ਜਾਂ ਕਰੈਡਿਟ ਕਾਰਡ ਹੁੰਦੇ ਨੇ ਇਹ ਉਨ੍ਹਾਂ ਦੀ ਕੌਪੀ ਵੀ ਤਿਆਰ ਕਰ ਸਕਦਾ ਹੈ ਇਹ ਤੋਂ ਇਲਾਵਾ ਵੀ ਜੇ ਇਹਦੀ ਪ੍ਰੋਗਰਾਮਿੰਗ ਕਰ ਦਿੱਤੀ ਜਾਵੇ ਹੋਰ ਅਤੇ ਇਹ ਹੋਰ ਵੀ ਇਹਦਾ ਆਪਾਂ ਹੈਕਿੰਗ ਦੀਆਂ ਚੀਜ਼ਾਂ ਕਰ ਸਕਦੇ ਹਾਂ ਅਤੇ ਇਹਦੀ ਜਿਹੜੀ ਸਭ ਤੋਂ ਵੱਡੀ ਵਿਸ਼ੇਸਤਾ ਮੈਨੂੰ ਲੱਗੀ ਸੀ ਉਹ ਵਾਈਫਾਈ ਹੈਕ ਕਰਨ ਦੀ ਸੀਗੀ ਜੇ ਮੈਨੂੰ ਕਦੇ ਇਹ ਮਿਲਦਾ ਹੈ ਤਾਂ ਮੈਂ ਇਹਦੇ ਨਾਲ ਵਾਈਫਾਈ ਹੈਕ ਕਰਨਾ ਚਾਹਾਂਗਾ